ਵੈਸੇ ਤਾਂ ਭੰਗੜੇ ਦੇ ਬਹੁਤ ਹੀ ਸਟੈਪ ਹਨ ਲੇਕਿਨ ਇਹਨਾਂ ਵਿੱਚੋਂ ਕੁਝ ਪ੍ਰਚਲਿਤ ਅਤੇ ਮਤਲਬ ਜਸ਼ਨ ਅਤੇ ਜ਼ੋਰਦਾਰ ਵਾਲੇ ਜਿਹੜੇ ਸਟੈਪ ਹਨ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਝੂਮਰ ਲੁੱਡੀ ਆਦਿ ਭੰਗੜੇ ਦੇ ਮਤਲਬ ਕੁਛ ਫੇਮਸ ਸਟੈਪ ਹਨ ਇਹਨਾਂ ਨੂੰ ਕਰਨ ਵਾਸਤੇ ਮਤਲਬ ਪੂਰਾ ਜੋਸ਼ ਚਾਹੀਦਾ ਹੁੰਦਾ ਹੈ ਅਤੇ ਬੰਦਾ ਫਿੱਟ ਵੀ ਪੂਰਾ ਹੋਣਾ ਚਾਹੀਦਾ ਹੈ ਕਿ ਮਤਲਬ ਵੈਸੇ ਤਾਂ ਭੰਗੜਾ ਕੋਈ ਵੀ ਕਰ ਸਕਦਾ ਹੈ ਮੋਟਾ ਪਤਲਾ ਆਦਮੀ ਭੰਗੜੇ ਦੇ ਕੁਛ ਆਮ ਸਟੈਪ ਇਹ ਹੀ ਹਨ ਅਤੇ ਇਹ ਮਤਲਬ ਹੋਰ ਜ਼ੋਰਦਾਰ ਅਤੇ ਜਸ਼ਨ ਵਾਲੇ ਵੀ ਹੁੰਦੇ ਹਨ ਅਤੇ ਇਹਨਾਂ ਨੂੰ ਕਰਨ ਲਈ ਜੋਸ਼ ਅਤੇ ਹੋਰ ਵੀ ਮਤਲਬ ਪਾਵਰ ਚਾਹੀਦੀ ਹੁੰਦੀ ਹੈ ਕਿ ਬੰਦਾ ਇਸ ਨੂੰ ਕਰਨ ਲਈ ਥ ਕਰਨ ਵੇਲੇ ਥੱਕੇ ਨਾ ਅਤੇ ਕਰਦਾ ਰਹੇ ਅਤੇ ਜਿਸ ਨੂੰ ਦੇਖਣ ਜਿਸ ਨਾਲ ਦੇਖਣ ਵਾਲਿਆਂ ਨੂੰ ਵੀ ਇਸ ਤਰ੍ਹਾਂ ਲੱਗੇ ਕਿ ਮਤਲਬ ਹਾਂ ਬੰਦੇ ਵਿੱਚ ਜੋਸ਼ ਅਤੇ ਜਸ਼ਨ ਹੈ ਮਤਲਬ ਜਸ਼ਨ ਵਾਲੇ ਦਿਨਾਂ ਵਿੱਚ ਇਹ ਮਨਾਇਆ ਜਾਂਦਾ ਹੈ